ਸਾਡੇ ਘਰਾਂ ਵਿੱਚ ਛੋਟੇ ਹੁੰਦਿਆਂ ਹੀ ਕੁੜੀਆਂ ਖਾਣਾ ਬਣਾਉਣਾ ਸ਼ੁਰੂ ਕਰ ਦਿੰਦੀਆਂ ਜਦੋਂ ਮੈਂ ਚੌਦਾਂ ਪੰਦਰਾਂ ਕੁ ਸਾਲ ਦੀ ਸੀ ਉਦੋਂ ਮੈਂ ਪਹਿਲੀ ਵਾਰ ਰੋਟੀ ਬਣਾਈ ਸੀ ਪਰ ਜਦੋਂ ਮੈਂ ਰੋਟੀ ਬਣਾਈ ਸੀ ਤਾਂ ਮੇਰੀਆਂ ਰੋਟੀਆਂ ਪਹਿਲਾਂ ਸੜ ਗਈਆਂ ਸੀ ਔਰ ਨਾ ਹੀ ਉਹਨਾਂ ਦੀ ਸ਼ੇਪ ਗੋਲ ਸੀ ਪਰ ਫਿਰ ਮੈਨੂੰ ਇਹ ਤਜ਼ਰਬਾ ਹੋਇਆ ਕਿ ਮੈਨੂੰ ਹਜੇ ਹੋਰ ਮਿਹਨਤ ਕਰਨ ਦੀ ਲੋੜ ਹੈ